ਵੈਸੇ ਤਾਂ ਆਪਾਂ ਗੱਲ ਕਰੀਏ ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾ ਦੀ ਇਹ ਪੰਜਾਬੀ ਨੂੰ ਬਹੁਤ ਢੰਗਾਂ ਨਾਲੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਅਤੇ ਆਪਾਂ ਪੰਜਾਬੀ ਭਾਸ਼ਾ ਪੰਜਾਬ ਦੇ ਵਿੱਚ ਰਹਿ ਕੇ ਜ਼ਿਆਦਾਤਰ ਆਪਾਂ ਪੰਜਾਬੀ ਭਾਸ਼ਾ ਬੋਲਣ ਤੋਂ ਹਿਚਕਚਾਉਂਦੇ ਹਾਂ ਕਿਉਂਕਿ ਆਪਣੇ ਪੰਜਾਬ ਦੇ ਵਾਸੀ ਜ਼ਿਆਦਾਤਰ ਅਗਰ ਬਾਹਰਲੇ ਮੁਲਕ ਜਾਂਦੇ ਹਨ ਕਨੇ ਕੈਨੇਡਾ ਵਗੈਰਾ ਜਾਂਦੇ ਹਨ ਜਾਂ ਬਾਹਰਲੇ ਮੁਲਕ ਜਿੱਥੇ ਵੀ ਜਾਂਦੇ ਹਨ ਉਹ ਅੰਗਰੇਜ਼ੀ ਭਾਸ਼ਾ ਨੂੰ ਬਹੁਤ ਮਹੱਤਵ ਦਿੰਦੇ ਹਨ ਉਹ ਅੰਗਰੇਜ਼ੀ ਭਾਸ਼ਾ ਨੂੰ ਬੋਲਣਾ ਆਪਣਾ ਮਾਣ ਸਮਝਦੇ ਹਨ ਜਦਕਿ ਉਹ ਇਹ ਗੱਲ ਨੂੰ ਭੁੱਲ ਚੁੱਕੇ ਹਨ ਕਿ ਪੰਜਾਬੀ ਸਾਡੀ ਮਾਤਰ ਭਾਸ਼ਾ ਹੈ ਜੋ ਕਿ ਸਾਡੇ ਦਾਦੇ ਪੜਦਾਦੇ ਉਹਨਾਂ ਦੇ ਵੀ ਬਜ਼ੁਰਗ ਬੋਲਦੇ ਆਏ ਹਨ ਅਤੇ ਇਸ ਲਈ ਇੱਕੋ ਆਪਾਂ ਅਗਰ ਗੱਲ ਕਰੀਏ ਬਾਹਰਲੇ ਮੁਲਕ ਦੀ ਚਾਹੇ ਆਪਾਂ ਗੱਲ ਕਰੀਏ ਕੈਨੇਡਾ ਦੀ ਚਾਹੇ ਗੱਲ ਕਰੀਏ ਇੰਗਲੈਂਡ ਦੀ ਉੱਥੇ ਦੇ ਜਿਹੜੇ ਗੋਰੇ ਲੋਕ ਹੈ ਉਹ ਆਪਣੀ ਅੰਗਰੇਜ਼ੀ ਭਾਸ਼ਾ ਨੂੰ ਮਹੱਤਵ ਦਿੰਦੇ ਹੈ ਉਹ ਅੰਗਰੇਜ਼ੀ ਤੋਂ ਇਲਾਵਾ ਹੋਰ ਕਿਸੇ ਭਾਸ਼ਾ 'ਚ ਗੱਲ ਨਹੀਂ ਕਰਦੇ ਹਨ ਉਹ ਆਪਣੀ ਅੰਗਰੇਜ਼ੀ ਭਾਸ਼ਾ ਨੂੰ ਮਹੱਤਵ ਦਿੰਦੇ ਹਨ ਆਪਾਂ ਕਿਉਂ ਨਹੀਂ ਆਪਣੀ ਪੰਜਾਬੀ ਮਾਤਰ ਭਾਸ਼ਾ ਦੇ ਵਿੱਚ ਗੱਲ ਕਰ ਸਕਦੇ ਹਾਂ ਆਪਾਂ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਇੰਟਰਨੈਸ਼ਨਲ ਸਕੂਲਾਂ ਦੇ ਵਿੱਚ ਜਾਂ ਕੋਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਆਪਾਂ ਆਪਣੇ ਬੱਚੇ ਨੂੰ ਟਿਊਸ਼ਨ ਵੀ ਲਗਾਉਂਦੇ ਹਾਂ ਜਾਂ ਸਕੂਲ ਵੀ ਭੇਜਦੇ ਹਾਂ ਆਪਾਂ ਉੱਥੇ ਟੀਚਰ ਨਾਲ ਗੱਲ ਕਰਦੇ ਹਨ ਕਿ ਆਪਣੇ ਬੱਚੇ ਨੂੰ ਕਿ ਅਸੀਂ ਆਪਣੇ ਬੱਚੇ ਨੂੰ ਅੰਗਰੇਜ਼ੀ ਜ਼ਿਆਦਾ ਪੜਾਇਓ ਜੀ ਕਿਉਂ ਕਿਉਂਕਿ ਆਪਾਂ ਆਪਣੀ ਪੰਜਾਬੀ ਮਾਤਰ ਭਾਸ਼ਾ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਆਪਾਂ ਗੱਲ ਕਰੀਏ ਜੂਨੀਅਰ ਐੱਨ ਟੀ ਆਰ ਬਾਰੇ ਸਾਊਥ ਦੇ ਬਹੁਤ ਬੜੇ ਸੁਪਰ ਸਟਾਰ ਉਹ ਆਪ ਤਾਮਿਲਨਾਡੂ ਦੇ ਰਹਿਣ ਵਾਲੇ ਹਨ ਅਤੇ ਉਹ ਆਪਣੀ ਤਾਮਿਲ ਭਾਸ਼ਾ ਦੇ ਵਿੱਚ ਹੀ ਕੋਈ ਵੀ ਇੰਟਰਵਿਊ ਦਿੰਦੇ ਹਨ ਨਾ ਕੀ ਉਹ ਨਾ ਅੰਗਰੇਜ਼ੀ ਬੋਲਦੇ ਹਨ ਨਾ ਕੋਈ ਹੋਰ ਕਿਸੇ ਭਾਸ਼ਾ ਦਾ ਪ੍ਰਯੋਗ ਕਰਦੇ ਹਨ ਅਤੇ ਇਸ ਕਰਕੇ ਸਭ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਆਪਣਾ ਪੰਜਾਬੀ ਮਾਤਰ ਭਾਸ਼ਾ ਨੂੰ ਵੱਧ ਤੋਂ ਵੱਧ ਯੋਗਦਾਨ ਦੇਵੋ ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬੀ ਭਾਸ਼ਾ ਆਪਣੇ ਪੰਜਾਬ ਤੋਂ ਹੀ ਖਤਮ ਹੋ ਜਾਵੇ ਸਾਡੀ ਮਾਤਰ ਭਾਸ਼ਾ ਧੰਨਵਾਦ ਜੀ